ਹੈਲੋ ਹਾਂਜੀ ਹਾਂਜੀ ਸਰ ਦੱਸੋ ਜੀ ਹਾਂਜੀ ਸਰ ਕੀ ਕਰਾਉਣਾ ਸੀਗਾ ਹਾਂਜੀ ਸਰ ਹੋਜੂਗੀ ਅਤੇ ਲੈਂਥ ਅਕੋਡਿੰਗ ਤੁਹਾਨੂੰ ਦੱਸ ਦਿੰਦੇ ਹਾਂ ਠੀਕ ਹੈ ਜੀ ਸ਼ੋਲਡਰ ਲੈਂਥ ਆਪਣੀ ਪੰਦਰਾਂ ਸੌ ਤੱਕ ਅਤੇ ਅਦਰ ਲੈਂਥ ਹੋਊਗੀ ਉਹ ਆਪਣੀ ਟੋ ਟੂ ਥਾਊਜੈਂਟ ਤੱਕ ਚੱਲ ਜੂਗੀ ਅਤੇ ਆਪਾਂ ਓਫਰ ਵਗੈਰਾ ਵੀ ਲਾ ਦਾਂਗੇ ਕਿਉਂਕਿ ਦੀਵਾਲੀ ਤੁਹਾਨੂੰ ਪਤਾ ਚੱਲ ਰਹੀ ਹੈ ਜੀ ਠੀਕ ਹੈ ਜੀ ਬਾਕੀ ਤੁਸੀਂ ਅਪੋਆਇੰਟਮੈਂਟ ਕਦੋਂ ਦੀ ਲੈਣੀ ਆ ਓਕੇ ਸਰ ਮੈਂ ਤੁਹਾਨੂੰ ਹੁਣੇ ਦੇਖ ਕੇ ਦੱਸ ਦਿੰਦਾ ਕਿ ਅਪੋਆਇੰਟਮੈਂਟ ਕਦੋਂ ਦੀ ਆ ਠੀਕ ਹੈ ਤੁਸੀਂ ਏਦਾਂ ਕਰਿਓ ਪੰਦਰਾਂ ਤਰੀਕ ਨੂੰ ਆ ਸਕਦੇ ਹੋ ਹਾਂਜੀ ਸਰ ਪੰਦਰਾਂ ਤਰੀਕ ਨੂੰ ਤੁਹਾਡੀ ਅਪੋਆਇੰਟਮੈਂਟ ਬੁੱਕ ਕਰ ਦਿੰਦੇ ਹਾਂ ਅਤੇ ਹੋਰ ਕੋਈ ਸਰਵਿਸ ਸਰ ਲੈਣੀ ਹੋਵੇ

ਹਾਂਜੀ ਸਰ ਤੁਹਾਡੇ ਕਰਸ ਵਗੈਰਾ ਕਰਨੇ ਆ ਜਾਂ ਕੋਈ ਕੈਮੀਕਲ ਵਰਕ ਕਰਨਾ ਓਕੇ ਸਰ ਅਸੀਂ ਓਫਰ ਲਾਇਆ ਹੋਇਆ ਜੈਂਟਸ ਦੇ ਮਤਲਬ ਕਿ ਦੀਵਾਲੀ ਓਫਰ ਡੀ ਟੈਨ ਫੇਸ਼ੀਅਲ ਦੇ ਨਾਲ ਕੈਰਾਟੀਨ ਦੇ ਨਾਲ ਅਤੇ ਹੇਅਰ ਕੱਟ ਦੇ ਨਾਲ ਆਪਾਂ ਨੂੰ ਵਨ ਥਾਊਜੈਂਟ ਦੇ ਵਿੱਚ ਆਪਾਂ ਸਾਰਾ ਕੁਛ ਕਰ ਦਿੰਦੇ ਹਾਂ ਠੀਕ ਹੈ ਜੀ ਅਤੇ ਰਿਬੋਨਡਿੰਗ ਕਰਾਉਣੀ ਹੋਵੇ ਜੈਂਟਸ ਨੇ ਤਾਂ ਆਪਾਂ ਨੌਂ ਸੌ ਰੁਪਏ ਦੇ ਵਿੱਚ ਡਨ ਕਰ ਦਿੰਦੇ ਹਾਂ ਬਾਕੀ ਇੱਕ ਹੋਰ ਓਫਰ ਲਾਇਆ ਹੋਇਆ ਆਪਾਂ ਪੰਦਰਾਂ ਸੌ ਦੇ ਵਿੱਚ ਆਪਾਂ ਡੀ ਟੈਨ ਪੈਕ ਵਿੱਦ ਰਿਬੋਨਡਿੰਗ ਵਿੱਦ ਕੱਟਸ ਵਗੈਰਾ ਕਰ ਦਿੰਦੇ ਹਾਂ ਠੀਕ ਆ ਕਲਾਇੰਟ ਅਕੋਡਿੰਗ ਹਾਂਜੀ ਸਰ ਇਕੱਲਾ ਰਿਬੋਨਡਿੰਗ ਆਪਾਂ ਕਰ ਦਾਂਗੇ ਸਰ ਹਜ਼ਾਰ ਰੁਪਏ ਚ ਆਪਾਂ ਕਰਦਾਂਗੇ ਸਰ ਜੇ ਤੁ ਤੁਹਾਡੀ ਵਾਈਫ ਨੇ ਕਰਾਉਣੀ ਆ ਠੀਕ ਆ ਸਰ ਆਪਾਂ ਉਨ੍ਹਾਂ ਨੂੰ ਓਫਰ ਲਾ ਕੇ ਆਪਾਂ ਦੋ ਕੁ ਹਜ਼ਾਰ ਦੇ ਵਿੱਚ ਆਪਾਂ ਫੁੱਲ ਰਿਬੋਨਡਿੰਗ ਡਨ ਕਰਦਾਂਗੇ ਠੀਕ ਹੈ ਅਤੇ ਹਾਂਜੀ ਸਰ ਬੋਲੋ ਜੀ ਹਾਂਜੀ ਹਾਂਜੀ ਸਰ ਓਫਰ ਮਿਲੂਗਾ ਜੀ ਮਿਲੂਗਾ ਮਿਲੂਗਾ ਜ਼ਰੂਰ ਮਿਲੂਗਾ ਤੁਹਾਡਾ ਤੁਸੀਂ ਦੋਨਾਂ ਨੇ ਕਰਾਉਣਾ ਅਤੇ ਤੁਹਾਡੇ ਵਾਈਫ ਨੂੰ ਆਪਾਂ ਕੀ ਕਰਾਉਣਾ ਤੁਹਾਡੀ ਵਾਈਫ ਨੇ ਕੈਰਾਟਿਨ ਕਰਾਉਣੀ ਆ ਜੀ ਕੈਰਾਟੀਨ ਆਪਾਂ ਉਨ੍ਹਾਂ ਦੀ ਪੰਦਰਾਂ ਸੌ 'ਚ ਕਰਦਾਂਗੇ ਅਤੇ ਤੁਹਾਡੀ ਕੈਰਾਟੀਨ ਆਪਾਂ ਸੱਤ ਸੌ ਰੁਪਏ 'ਚ ਕਰਦਾਂਗੇ ਹਾਂਜੀ ਸਰ ਹੋਰ ਕੋਈ ਸਰਵਿਸ ਕਲਰ ਵਗੈਰਾ ਬੇਸ ਕਲਰ ਕਰਾਉਣਾ ਫੈਸ਼ਨ ਸ਼ੇਡ ਕਰਾਉਣਾ ਜੀ ਫੈਸ਼ਨ ਸ਼ੇਡ ਆਪਾਂ ਕਰਦਾਂਗੇ ਸਰ ਤੁਹਾਨੂੰ ਇੱਕ ਦਿਨ ਪਹਿਲਾਂ ਆਉਣਾ ਪੈਣਾ ਆਪਾਂ ਚੈੱਕ ਕਰਲਾਂਗੇ ਤੁਸੀਂ ਕਿਹੜਾ ਪਲੇ ਬੌਂਡਡ ਕਰਾਉਣਾ ਐਸ਼ ਕਰਾਉਣਾ ਜਿਹੜਾ ਮਰਜ਼ੀ ਦੱਸੋ ਕਿਹੜਾ ਕਰਾਉਣਾ ਜੀ ਐਸ਼ ਕਲਰ ਕਰਾਉਣਾ ਸਰ ਹਾਈਲਾਈਟਿੰਗ ਪੁਆਉਣੀ ਹੈ ਵਾਲਾਂ 'ਚ ਹਾਂਜੀ ਹਾਂਜੀ ਸਰ ਇਹਦਾ ਮਤਲਬ ਕਿ ਤੁਹਾਨੂੰ ਪੈਜੂਗਾ ਕੈਰਾਟਿਨ ਪਲੱਸ ਕਲਰ ਤੁਹਾਨੂੰ ਜੀ ਸੱਤ ਸੌ ਸਾਢੇ ਸੱਤ ਸੌ ਕੈਰਾਟੀਨ ਸਰ ਤੁਹਾਨੂੰ ਹਜ਼ਾਰ ਦੇ ਪੈਕ ਵਿੱਚ ਪੂਰਾ ਕਲਰ ਆਪਾਂ ਡਨ ਕਰਦਾਂਗੇ ਵਿੱਦ ਕੈਰਾਟੀਨ ਇਹ ਓਫਰ ਲਾ ਕੇ ਤੁਹਾਨੂੰ ਇਹ ਮੈਂ ਪ੍ਰਾਈਜ਼ ਦੱਸਿਆ ਹੋਇਆ ਠੀਕ ਹੈ ਜੀ ਜੇ ਆਪਾਂ ਓਫਰ ਨਾ ਲਾਈਏ ਇਹ ਜਾਂਦਾ ਦੋ ਹਜ਼ਾਰ ਤੱਕ ਜੀ ਹਾਂਜੀ ਸਰ ਨਹੀਂ ਸਰ ਆਪਾਂ ਪ ਕੈਰਾਟੀਨ ਦੇ ਪ੍ਰੋਡਕਟਜ ਅ ਕੈਰਾ ਫਾਈਨ ਦੇ ਵਰਤਾਂਗੇ ਅਤੇ ਆਪਾਂ ਕਲਰ ਜਿਹੜੇ ਵਰਤਾਂਗੇ ਉਹ ਆਪਾਂ ਮੈਟ੍ਰਿਕਸ ਦੇ ਲੋਰੀਅਲ ਦੇ ਵਰਤਾਂਗੇ ਸਰ ਆਪਾਂ ਗਰੰਟੀ ਦੇਵਾਂਗੇ ਤਿੰਨ ਮਹੀਨਿਆਂ ਦੀ ਤੁਹਾਡੇ ਵਾਲਾਂ ਨੂੰ ਕੁਛ ਨਹੀਂ ਹੁੰਦਾ ਅਤੇ ਤਿੰਨ ਮਹੀਨਿਆਂ ਬਾਅਦ ਤੁਸੀਂ ਸਪਾ ਦੀ ਟੀਸ ਸਿਟਿੰਗਸ ਲੈ ਸਕਦੇ ਹੋ ਹਾਂਜੀ ਸਰ ਸਰ ਜਿਹੜੇ ਤੁਸੀਂ ਫੈਸ਼ਨ ਸ਼ੇਡ ਕਹਿ ਸਕਦੇ ਰਹੇ ਹੋ ਸਿਕਸ ਵੋਕਸ ਵੋਸ਼ ਤੱਕ ਉਹ ਰਹਿਣਗੇ ਕਿਉਂਕਿ ਸਰ ਇਹ ਪਈ ਪਈਬੌਂਡਡ ਹੁੰਦੇ ਆ ਉਹ ਅਤੇ ਸਿਕਸ ਵੋਸ਼ ਤੱਕ ਰਹਿਣਗੇ ਆਪਾਂ ਤੁਹਾਨੂੰ ਇੱਕ ਸ਼ੈਂਪੂ ਰਿਕ ਰਿਕੁਐਰਮੈਂਟ ਕਰਦਾਂਗੇ ਤੁਸੀਂ ਉਹ ਸ਼ੈਂਪੂ ਯੂਜ ਕਰਨਾ ਅਤੇ ਤੁਹਾਡਾ ਸਟੇਬਿਲਟੀ ਬਹੁਤ ਜ਼ਿਆਦੇ ਰਹਿਣਗੀ ਅਤੇ ਸਰ ਕੈਰਾ ਕੈਰਾਟੀਨ ਦੇ ਆਪਾਂ ਕਰ ਦਿੰਦੇ ਹਾਂ ਕਿ ਤਿੰਨ ਮਹੀਨੇ ਤੱਕ ਕਰਨਗੇ ਤੁਹਾਨੂੰ ਕੈਰਾ ਫਾਈਨ ਦੇ ਸ਼ੈਂਪੂ ਵਗੈਰਾ ਯੂਜ ਕਰਨੇ ਪੈਣਗੇ ਸਰ ਫਸਟ ਵੋਸ਼ ਸਾਡਾ ਤੁਹਾਡਾ ਸਲੂਨ 'ਚ ਹੋਊਗਾ ਜੀ ਹਾਂਜੀ ਸਰ ਹਾਂਜੀ ਸਰ ਠੀਕ ਹੈ ਸਰ ਓਕੇ ਸਰ ਥੈਂਕ ਯੂ ਸਰ ਓਕੇ ਸਰ